ਕਦੋਂ ਸਰ ਹਾਂਜੀ ਸਰ ਹਾਂਜੀ ਜੀ ਸਰ ਹਾਈਜੀਨ ਦਾ ਧਿਆਨ ਹੀ ਹੁੰਦਾ ਸਰ ਤੁਸੀਂ ਆਏ ਸੀ ਕਦੋਂ ਆਏ ਸੀ ਤੁਸੀਂ ਕੱਲ੍ਹ ਆਏ ਸੀ ਕੱਲ੍ਹ ਕਿਸ ਟਾਈਮ

ਸਰ ਉਹ ਉਹ ਸਰ ਉਹ ਸਰ ਗੱਲ ਕੀ ਹੈ ਵੀ ਆਪਾਂ ਮੁੰਡਾ ਰੱਖਿਆ ਸੀ ਨਾ ਜਿਹੜਾ ਉਹਨੂੰ ਉਹਦੇ ਘਰ ਵਿਆਹ ਹੈਗਾ ਉਹ ਉਹ ਚਲਾ ਗਿਆ ਨਵੇਂ ਮੁੰਡੇ ਆਏ ਉਨ੍ਹਾਂ ਨੂੰ ਥੋੜ੍ਹਾ ਪਤਾ ਨਹੀਂ ਹੈ ਅਤੇ ਉਹ ਤਾਂ ਕਰਕੇ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਕੋਈ ਨਹੀਂ ਤੁਸੀਂ ਹੁਣ ਕਦੋਂ ਆਉਗੇ ਤਾਂ ਆਪਾਂ ਬਿਲਕੁਲ ਧਿਆਨ ਰੱਖਾਂਗੇ ਜੇ ਹੋਰ ਵੀ ਕੋਈ ਤੁਹਾਨੂੰ ਦਿੱਕਤ ਹੋਈ ਹੈ ਤਾਂ ਦੱਸੋ ਤਾਂ ਆਪਾਂ ਪੂਰਾ ਤੁਹਾਡਾ ਫੀਡਬੈਕ ਦਾ ਸਨਮਾਨ ਕਰਦੇ ਹਾਂ ਸਨਮਾਨ ਆਪਾਂ ਹਾਂਜੀ ਸਰ ਉਹ ਗੱਲ ਤਾਂ ਸਹੀ ਹੈ ਸਰ ਪਰ ਮੈਂ ਕਹਿ ਤਾਂ ਰਿਹਾ ਵੀ ਮੁੰਡੇ ਆਪਾਂ ਵਧੀਆ ਰੱਖੇ ਸੀ ਚਲੋ ਕੋਈ ਨਹੀਂ ਹਾਈਜੀਨ ਦਾ ਅਸੀਂ ਰੱਖਾਂਗੇ ਧਿਆਨ ਤੁਸੀਂ ਕਹਿ ਰਹੇ ਹੋ ਤਾਂ ਕੋਈ ਨਾ ਕੋਈ ਦਿੱਕਤ ਹੋਣੀ ਹੈ ਤਾਂ ਹੀ ਕਹਿ ਰਹੇ ਹੋ ਫੇਰ ਕਰਦੇ ਹਾਂ ਕੋਈ ਨਹੀਂ ਮਨਟੇਨ ਆਪਾਂ ਹੋਰ ਕੋਈ ਪਰੇਸ਼ਾਨੀ ਦਿੱਕਤ ਉਹ ਸਰ ਉਹ ਸਮਾਨ ਸਮਾਨ ਤਾਂ ਸਰ ਉਹ ਸਮਾਨ ਤਾਂ ਸਰ ਉਹ ਤੁਹਾਨੂੰ ਪਤਾ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਅਤੇ ਆਪਾਂ ਲਿਆਏ ਤਾਂ ਵਾਹਵਾ ਹੀ ਸੀ ਬਸ ਟੈਮ ਟੈਮ ਨਾਲ ਹੀ ਮੁੱਕ ਗਿਆ ਨਹੀਂ ਕੋਈ ਨਹੀਂ ਸਰ ਆਪਾਂ ਸਮਾਨ ਸਮਾਨ ਵੀ ਪੂਰਾ ਰੱਖਾਂਗੇ ਤੁਸੀਂ ਆਇਓ ਤੁਹਾਡੇ ਫਰੈਂਡ ਜੋ ਵੀ ਤੁਹਾਡੇ ਨਾਲ ਆਏ ਸੀ ਤੁਸੀਂ ਸੈਕੰਡ ਟਾਈਮ ਜਦੋਂ ਵੀ ਆਏ ਓਨਾ ਹੀ

ਨਹੀਂ ਸਰ ਤੁਸੀਂ ਤੁਸੀਂ ਆਇਓ ਇਸ ਵਾਰ ਤੁਸੀਂ ਆਇਓ ਤੁਹਾਡੇ ਫਰੈਂਡ ਜੋ ਵੀ ਤੁਹਾਡੇ ਨਾਲ ਸੀ ਦੋਸਤ ਤੁਸੀਂ ਸਾਰੇ ਆਇਓ ਇਸ ਵਾਰ ਤੁਹਾਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਆਪਾਂ ਪ੍ਰੋਪਰ ਸਭ ਚੀਜ਼ ਦਾ ਧਿਆਨ ਰੱਖਾਂਗੇ ਤੁਸੀਂ ਕੋਈ ਨਹੀਂ ਇੱਕ ਵਾਰੀ ਜ਼ਰੂਰ ਫੇਰ ਵਿਜਿਟ ਕਰਿਓ ਠੀਕ ਠੀਕ ਹੈ ਸਰ